ਬਹੁਤ ਸਾਰੀਆਂ ਭਾਰਤੀ ਕਲਾ ਸ਼ੈਲੀਆਂ ਨੇ ਜਿਹੜੀਆਂ ਹੁਣ ਅਲੋਪ ਹੋ ਰਹੀਆਂ ਔਰ ਸਾਨੂੰ ਚਾਹੀਦਾ ਕਿ ਉਹਦੀ ਸੰਭਾਲ ਕਰੀਏ ਕਿਉਂਕਿ ਹਰ ਕਿਸੇ ਵੀ ਦੇਸ਼ ਦੀ ਸੰਸਕ੍ਰਿਤੀ ਜਾਂ ਉਹਦੀ ਜਿਹੜੀ ਕਲਾ ਹੁੰਦੀ ਹੈ ਉਹਦਾ ਮਾਣ ਹੁੰਦੀ ਹੈ ਅਤੇ ਜਿਵੇਂ ਕਿ ਜਿਹੜੇ ਲੋਕ ਨਾਚ ਆ ਸਾਡੇ ਅਲੱਗ ਅਲੱਗ ਇਲਾਕਿਆਂ ਵਿੱਚ ਪੰਜਾਬ ਦੇ ਹੈ ਜਾਂ ਦੂਸਰੇ ਏਰੀਆਜ਼ ਦੇ ਵਿੱਚ ਹੈ ਇਹ ਲੋਕ ਨਾਚ ਸਾਡੀ ਇੱਕ ਬੜੀ ਪਹਿਚਾਣ ਹੁੰਦੇ ਆ ਔਰ ਮਤਲਬ ਕਈ ਤਰ੍ਹਾਂ ਨਾਲ ਇਹਦੀ ਬੜਾ ਮਹੱਤਵ ਹੁੰਦਾ ਹੈ ਇਸੇ ਤਰ੍ਹਾਂ ਨਾਲ ਜਿਹੜਾ ਹੱਥ ਹੱਥਾਂ ਦਾ ਸ਼ਿਲਪ ਕੋਈ ਲੱਕੜੀ ਦੇ ਉੱਤੇ ਜਾਂ ਕੋਈ ਪੱਥਰ ਉੱਤੇ ਜਿਹੜੀਆਂ ਹੱਥਾਂ ਦਾ ਸ਼ਿਲਪ ਹੁੰਦਾ ਸੀ ਜਿਹੜਾ ਹੋਇਆ ਕਰਦਾ ਸੀ ਹੁਣ ਅੱਜ ਦੀ ਡੇਟ 'ਚ ਇਹੋ ਜਿਹੇ ਕੋਈ ਕਾਰੀਗਰ ਨਹੀਂ ਮਿਲਦੇ ਅਲੋਪ ਹੋ ਰਹੇ ਆ ਠੀਕ ਹੈ ਕਿ ਨਵੀਆਂ ਟੈਕਨੋਲੋਜੀ ਆ ਗਈ ਹੈ ਲੇਕਿਨ ਉਹਦਾ ਇੱਕ ਆਪਣਾ ਇੱਕ ਰਸ ਇੱਕ ਉਹਦੀ ਕਲਾ ਹੈ ਸੋ ਇਸੇ ਤਰ੍ਹਾਂ ਨਾਲ ਕਹਿ ਲਓ ਕਿ